ਹੈਲੋ ਹਾਂਜੀ ਰਾਮ ਰਾਮ ਜੀ ਮੈਂ ਏ ਬੀ ਏ ਬੀ ਪੀ ਨਿਊਜ਼ ਤੋਂ ਬੋਲ ਰਹੀ ਹਾਂ ਹਾਂਜੀ ਮੈਂ ਪੁੱਛਣਾ ਚਾਹੁੰਦੀ ਸੀ ਕਿ ਅੰਮ੍ਰਿਤਸਰ 'ਚ ਕੀ ਕੀ ਡਿਵੈਲਪਮੈਂਟ ਹੋਈ ਹੋਈ ਆ ਕਿਸ ਤਰ੍ਹਾਂ ਕੁਛ ਵਧੀਆ ਵਿਕਸਿਤ ਹੋਇਆ ਅੰਮ੍ਰਿਤਸਰ ਜਾਂ ਨਹੀਂ ਅਤੇ ਹੋਰ ਮੈਂ ਪੁੱਛਣਾ ਚਾਹੁੰਦੀ ਸੀ ਕਿ ਇਸ ਤੋਂ ਇਲਾਵਾ ਅੰਮ੍ਰਿਤਸਰ ਵਾਸੀਆਂ ਨੂੰ ਕੋਈ ਦਿੱਕਤ ਆ ਰਹੀ ਹੋਵੇ ਚਲੋ ਜੀ ਠੀਕ ਹੈ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡੀ ਜਾਣਕਾਰੀ ਦੇਣ ਵਾਸਤੇ ਥੈਂਕ ਯੂ ਜੀ